ਪਸ਼ੂ ਪਾਲਣ ਦੇ ਨਾਲ ਨਾਲ ਕਈ ਲੋਕ ਇਹਨਾਂ ਤੋਂ ਹੋਰ ਵੀ ਕੰਮ ਲੈ ਲੈਂਦੇ ਹਨ ਜਿਵੇਂ ਕਿ ਜਿਵੇਂ ਕਿ ਇਹਨਾ ਜਦੋਂ ਕੋਈ ਜਾਨਵਰ ਮਰ ਜਾਂਦਾ ਹੈ ਤਾਂ ਇਹਨਾਂ ਦੀਆਂ ਹੱਡੀਆਂ ਵੇਚ ਦਿੰਦੇ ਹਨ ਇਹਨਾਂ ਦੀ ਖੱਲ ਵੀ ਵਿਕਦੀ ਹੈ ਜਿਹੜੀ ਕਿ ਜਿ ਜਿਹਦਾ ਚਮੜਾ ਬਣਦਾ ਹੈ ਚਮੜੇ ਤੋਂ ਜੁੱਤੇ ਆਦਿ ਵੀ ਬਣਦੇ ਹਨ ਇਸ ਤਰ੍ਹਾਂ ਕੋਈ ਮੀਟ ਦਾ ਕੰਮ ਅੰਡੇ ਅੰਡਿਆਂ ਦਾ ਵੀ ਕੰਮ ਕਰਦਾ ਹੈ ਦੁੱਧ ਵੀ ਆਪਾਂ ਘਰਾਂ ਵਿੱਚ ਵਰਤਦੇ ਹਾਂ ਅਤੇ ਦੁੱਧ ਤੋਂ ਦਹੀਂ ਮੱਖਣ ਆਦਿ ਵੀ ਬਣ ਜਾਂਦਾ ਹੈ ਇਸ ਤਰ੍ਹਾਂ ਕਈਆਂ ਦਾ ਵਪਾਰ ਚਲ ਜਾਂਦਾ ਹੈ ਜਿੱਦਾਂ ਹਾਥੀ ਦੰਦ ਤੋਂ ਚੂੜਾ ਬਣ ਜਾਂ ਬਣਦਾ ਹੈ ਅਤੇ ਪਸ਼ੂਆਂ ਦੇ ਮਲ ਮੂਤਰ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ ਵੀ ਕਈ ਜਦੋਂ ਖੇਤਾਂ ਵਿੱਚ ਖਲ ਦੀ ਲੋੜ ਹੁੰਦੀ ਹੈ ਤਾਂ ਇਹਨਾਂ ਦੇ ਗੋਬਰ ਮਲ ਮੂਤਰ ਤੋਂ ਵੀ ਬਣਦੀ ਹੈ ਜਿਸ ਨਾਲ ਸਬਜ਼ੀਆਂ ਦਾ ਉਤਪਾਦ ਵੀ ਵਧੀਆ ਹੋ ਜਾਂਦਾ ਹੈ ਇਸ ਤਰ੍ਹਾਂ ਇਹਨਾਂ ਦੀ ਵਰਤੋਂ ਕਾਫੀ ਜਗ੍ਹਾ ਵਿੱਚ ਕੀਤੀ ਜਾਂਦੀ ਹੈ